ਇੱਕ ਜ਼ੀਰੋ ਇੱਕ ਚਾਰ ਇੱਕ ਛੇ ਦੋ ਜੀਰੋ ਸੱਤ ਪੰਜ ਛੇ ਸੱਤ ਇੱਕ ਚਾਰ ਪੰਜ ਜੀਰੋ ਸੱਤ ਛੇ ਪੰਜ ਛੇ ਜ਼ੀਰੋ ਸੱਤ ਅੱਠ ਜੀਰੋ ਸੱਤ ਛੇ ਸੱਤ ਅੱਠ ਛੇ ਸੱਤ